ਪੰਜਾਬ ਵਿੱਚ ਜੋ ਵੀ ਲੋਕ ਗਰੀਬ ਹਨ ਜਾਂ ਕਮਜ਼ੋਰ ਸਮੂਹਾਂ ਦੇ ਹਨ ਜਿਵੇਂ ਕਿ ਬੱਚੇ ਔਰਤਾਂ ਜਾਂ ਘੱਟ ਗਿਣਤੀਆਂ ਉਹਨਾਂ ਦੀ ਰੱਖਿਆ ਅਤੇ ਅਧਿਕਾਰਾਂ ਲਈ ਉਰੇ ਵੈਸੇ ਤਾਂ ਭਾਰਤ ਵਿੱਚ ਹੀ ਇੱਕ ਫ੍ਰੀ ਲੀਗਲ ਏਡ ਕਾਨੂੰਨ ਬਣਾਇਆ ਗਿਆ ਹੈ ਜਿਸ ਵਿੱਚ ਕਿ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਅਗਰ ਕਿਸੇ ਨੂੰ ਕੋਈ ਵਕੀਲ ਕਰਨ ਦੇ ਉਹ ਅਸਮਰਥ ਹੁੰਦਾ ਹੈ ਤਾਂ ਉਸਨੂੰ ਫ੍ਰੀ ਲੀਗਲ ਏਡ ਕਾਨੂੰਨੀ ਸੇਵਾਵਾਂ ਵੱਲੋਂ ਵਕੀਲ ਵੀ ਮਹੁੱਈਆ ਕਰਾਇਆ ਜਾਂਦਾ ਹੈ ਅਤੇ ਉਸਨੂੰ ਕਿਸੇ ਵੀ ਪੈਸੇ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਅਗਰ ਕਿਸੇ ਬੱਚੇ ਜਾਂ ਕਿਸੇ ਬੱਚੀ ਦੇ ਨਾਲ ਕਿਸੇ ਨਾਲ ਦੁਸ਼ਕਰਮ ਕੀਤਾ ਹੋਵੇ ਤਾਂ ਉਹਨਾਂ ਦੇ ਲਈ ਕਾਨੂੰਨ ਵਿੱਚ ਉਹਨਾਂ ਨੂੰ ਸ ਦੁਸ਼ਮਣ ਜਿਹੜੇ ਦੋਸ਼ੀ ਹਨ ਉਹਨਾਂ ਵਾਸਤੇ ਸਖਤ ਸਜਾਵਾਂ ਵੀ ਹਨ ਅਤੇ ਜੋ ਬੱਚੇ ਹਨ ਉਹਨਾਂ ਨੂੰ ਕੰਪਨਸੇਸ਼ਨ ਵੀ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ